ਹਾਂਜੀ ਹਾਂਜੀ ਹਾਂਜੀ ਅੱਛਾ ਜੀ ਮੈਮ ਤੁਸੀਂ ਆ ਗਏ ਹੋ ਜਾਂ ਆਉਣਾ ਹੈ ਅੱਛਾ ਜੀ ਆਉਣਾ ਹੈ ਤਾਂ ਤੁਸੀਂ ਇੱਥੇ ਬੋਡਰ ਦੇਖ ਸਕਦੇ ਹੋ ਇੰਡੀਆ ਅਤੇ ਪਾਕਿਸਤਾਨ ਦਾ ਬੋਡਰ ਹੈ ਜਿੱਥੇ ਰਿਟ੍ਰੀਟ ਸੈਰੇਮਨੀ ਹੁੰਦੀ ਹੈ ਜਿਸ ਤਰ੍ਹਾਂ ਵਾਘਾ ਬੋਡਰ 'ਤੇ ਹੁੰਦੀ ਹੈ ਸੇਮ ਫਾਜਿਲਕਾ ਬੋਡਰ 'ਤੇ ਵੀ ਹੁੰਦੀ ਹੈ ਸਦਕੀ ਬੋਡਰ ਉਹਦਾ ਨਾਮ ਹੈ ਔਰ ਤੁਸੀਂ ਆਸਰ ਵਾਲਾ ਵਾਰ ਮੈਮੋਰੀਅਲ ਉੱਨੀ ਸੌ ਇਕਹੱਤਰ ਦੀ ਭਾਰਤ ਪਾਕ ਲੜਾਈ ਦੇ ਵਿੱਚ ਜੋ ਜਵਾਨ ਸ਼ਹੀਦ ਹੋਏ ਸਨ ਉਨ੍ਹਾਂ ਬਾਰੇ ਸਾਰਾ ਉੱਥੇ ਇੱਕ ਮਿਊਜ਼ੀਅਮ ਬਣਿਆ ਹੋਇਆ ਹੈ ਔਰ ਉੱਥੇ ਕੁਛ ਜੋ ਪਾਕਿਸਤਾਨ ਦੀ ਫੋਜ ਨੇ ਆਪਨੇ ਟੈਂਕ ਔਰ ਉਹ ਛੱਡ ਕੇ ਗਏ ਸੀ ਉਹ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਫਾਜ਼ਿਲਕਾ ਦਾ ਕਲੋਕ ਟਾਵਰ ਹੈ ਜੋ ਤੁਸੀਂ ਉੱਨੀ ਸੌ ਚੌਂਤੀ ਦੇ ਵਿੱਚ ਬਣਿਆ ਸੀ ਉਹ ਇੱਕ ਦੇਖਣ ਵਾਲੀ ਚੀਜ਼ ਹੈ ਫਾਜ਼ਿਲਕਾ ਦੇ ਵਿੱਚ ਏਸ਼ੀਆ ਦਾ ਦੂਜੇ ਨੰਬਰ ਦਾ ਸਭ ਤੋਂ ਵੱਡਾ ਟੀਵੀ ਟਾਵਰ ਹੈ ਜਿਹਨੂੰ ਲੋਕ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਹਨ ਕਿ ਇਹ ਇਸ ਤਰ੍ਹਾਂ ਇੱਕ ਬਹੁਤ ਅੱਛੀ ਚੀਜ਼ ਹੈ ਪ੍ਰਤਾਪ ਬਾਗ਼ ਤੁਸੀਂ ਘੁੰਮ ਸਕਦੇ ਹੋ ਤੁਸੀਂ ਫਾਜ਼ਿਲਕਾ ਦੇ ਵਿੱਚ ਫੇਮਸ ਤੋਸ਼ਾ ਜੋ ਇੱਕ ਬਹੁਤ ਅੱਛਾ ਖਾਣ ਦਾ ਮਤਲਬ ਮਿਠਿਆਈ ਹੈ ਉਹ ਤੁਸੀਂ ਜਾਂਦੇ ਹੋਏ ਇੱਕ ਆਪਣੀ ਯਾਦਗਾਰੀ ਦੇ ਤੌਰ 'ਤੇ ਲਿਜਾ ਸਕਦੇ ਹੋ ਤੁਸੀਂ ਪੰਜਾਬੀ ਜੁੱਤੀ ਲਿਜਾ ਸਕਦੇ ਹੋ ਪੰਜਾਬੀ ਜੁੱਤੀ ਪੂਰੇ ਪੰਜਾਬ ਦੇ ਵਿੱਚ ਫਾਜ਼ਿਲਕਾ ਦੀ ਫੇਮਸ ਹੈ ਮੈਮ ਇੱਥੇ ਕਈ ਹੋਟਲ ਅਵੇਲੇਬਲ ਹਨ ਥ੍ਰੀ ਸਟਾਰ ਤੱਕ ਦੇ ਹੋਟਲ ਅਵੇਲੇਬਲ ਹਨ ਤੁਸੀਂ ਔਰ ਜੋ ਉਨ੍ਹਾਂ ਦਾ ਖਰਚਾ ਹੈ ਉਹ ਵੀ ਬੜਾ ਜਾਇਜ਼ ਹੈ ਫਸਿਲਟੀਜ ਹਨ ਅਗਰ ਤੁਸੀਂ ਉਸ ਤੋਂ ਵੀ ਘੱਟ ਦੇ ਵਿੱਚ ਰਹਿਣਾ ਚਾਹੰਦੇ ਹੋ ਤਾਂ ਗੈਸਟ ਹਾਊਸ ਵੀ ਅਵੇਲੇਬਲ ਹੈਗੇ ਹਨ ਹਾਂਜੀ ਮੈਮ ਕੈਬ ਮਿਲ ਜਾਏਗੀ ਕੈਬ ਜੋ ਨੋਮੀਨਲ ਚਾਰਜਿਜ ਹੋਣਗੇ ਉਹਦੇ ਹਿਸਾਬ ਨਾਲ ਕੋਈ ਬਹੁਤ ਜ਼ਿਆਦਾ ਰੇਟ ਨਹੀਂ ਪੈਂਦਾ ਹਾਂਜੀ ਮੈਮ ਹਾਂਜੀ ਠੀਕ ਹੈ